ਅਸੀਂ ਸਾਡੇ ਖੇਤਰ ਦੇ ਵਿੱਚ ਬਹੁਤ ਸਾਰੇ ਨਵੇਂ ਕਾਰੋਬਾਰ ਜਿਵੇਂ ਮੱਛੀ ਪਾਲਣ ਬੱਕਰੀ ਪਾਲਣ ਮਧੂਮੱਖੀ ਪਾਲਣ ਅਤੇ ਪਸ਼ੂ ਪਾਲਣ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹਾਂ ਅਸੀਂ ਮੱਛੀ ਪਾਲਣ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਾਂ ਇਹਨਾਂ ਕਾਰੋਬਾਰ ਦੇ ਵਿੱਚ ਬਹੁਤ ਸਾਰਾ ਲਾਭ ਵੀ ਮਿਲਦਾ ਹੈ ਅਤੇ ਅਸੀਂ ਕਈ ਜਣੇ ਮਿਲ ਕੇ ਇੱਕ ਦੂਜੇ ਨੂੰ ਕੰਮ ਸ ਸਿਖਾ ਵੀ ਸਕਦੇ ਹਾਂ ਅਤੇ ਇੱਕ ਦੂਜੇ ਤੋਂ ਕੰਮ ਸਿੱਖ ਵੀ ਸਕਦੇ ਹਾਂ ਇਹਨਾਂ ਨਾਲ ਪੈਸਾ ਵੀ ਕਮਾਇਆ ਜਾ ਸਕਦਾ ਹੈ ਅਤੇ ਜਿਹੜੀਆਂ ਕੁਦਰਤੀ ਚੀਜ਼ਾਂ ਹਨ ਜਿਵੇਂ ਮਧੂਮੱਖੀ ਪਾਲਣ ਤੋਂ ਸ਼ਹਿਦ ਇਕੱਠਾ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਹੋਰ ਵੀ ਬਹੁਤ ਕਾਰੋਬਾਰ ਹਨ ਜਿਹਨਾਂ ਦੇ ਵਿੱਚ ਅਸੀਂ ਕੁਦਰਤੀ ਚੀਜ਼ਾਂ ਨੂੰ ਪ੍ਰਾਪਤ ਕਰ ਸਕਦੇ ਹਾਂ ਅਤੇ ਇਸ ਨਾਲ ਮਤਲਬ ਸਿਹਤ 'ਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ ਜੇ ਕੁਦਰਤੀ ਚੀਜ਼ਾਂ ਨੂੰ ਅਸੀਂ ਆਪਣੇ ਕਾਰੋਬਾਰ ਦੇ ਵਿੱਚੋਂ ਪ੍ਰਾਪਤ ਕਰਦੇ ਹਾਂ ਇਹਨਾਂ ਕਾਰੋਬਾਰ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਵੀ ਹੁੰਦਾ ਹੈ ਅਤੇ ਇਹ ਬੇਰੁਜ਼ਗਾਰੀ ਵੀ ਖਤਮ ਹੁੰਦੀ ਹੈ ਹੈ ਜੇਕਰ ਸਾਡੇ ਖੇਤਰ ਦੇ ਵਿੱਚ ਇਹ ਕਾਰੋਬਾਰ ਸ਼ੁਰੂ ਕੀਤੇ ਜਾਣਗੇ ਇਹ ਤਾਂ ਇਹਨਾਂ ਦੇ ਨਾਲ ਇਨਕਮ ਦਾ ਸੋਰਸ ਵੀ ਜ਼ਿਆਦਾ ਵਧੇਗਾ ਅਤੇ ਇਹ ਬਹੁਤ ਸਾਰੇ ਲੋਕਾਂ ਨੂੰ ਕੰਮ ਵੀ ਮਿਲੇਗਾ ਇਹ ਬਹੁਤ ਹੀ ਲੋਕਾਂ ਦੇ ਲਈ ਇਹ ਕਾਰੋਬਾਰ ਬਹੁਤ ਜ਼ਿਆਦਾ ਫਾਇਦੇਮੰਦ ਹਨ ਹਰ ਇੱਕ ਕੰਮ ਦੇ ਵਿੱਚ ਇੱਕ ਹੁਨਰ ਹੋਣਾ ਜ਼ਰੂਰੀ ਹੈ ਇਸ ਲਈ ਇਹਨਾਂ ਕੰਮਾਂ ਨੂੰ ਕਰਨ ਦੇ ਲਈ ਹੀ ਹਰ ਕੋਲ ਇ ਕੋਲ ਹੁਨਰ ਹੋਣਾ ਚਾਹੀਦਾ ਹੈ ਅਤੇ ਇਹ ਕੰਮਾਂ ਦੇ ਕਰਨ ਦੇ ਨਾਲ ਅਸੀਂ ਬਹੁਤ ਸਾਰਾ ਪੈਸਾ ਕਮਾ ਸਕਦੇ ਹਾਂ